ਹਾਂਜੀ ਜਦੋਂ ਅਸੀਂ ਰਸੋਈ ਵਿੱਚ ਖਾਣਾ ਪਕਾਉਂਦੇ ਹਾਂ ਤਾਂ ਸਭ ਤੋਂ ਜਿਹੜਾ ਉਪਕਰਨ ਮੇਨ ਹੈ ਅਸੀਂ ਦਾਲ ਸਬਜ਼ੀ ਜਿਹੜੀ ਬਣਾਉਂਦੇ ਹਾਂ ਉਹ ਹੈ ਪ੍ਰੈਸ਼ਰ ਕੁੱਕਰ ਜਾਂ ਪਤੀਲਾ ਅਗਰ ਅਸੀਂ ਗੱਲ ਕਰੀਏ ਪ੍ਰੈਸ਼ਰ ਕੁੱਕਰ ਦੀ ਤਾਂ ਪ੍ਰੈਸ਼ਰ ਕੁੱਕਰ ਵਿਚ ਜਦੋਂ ਅਸੀਂ ਖਾਣਾ ਬਣਾਉਂਦੇ ਹਾਂ ਸਾਡੇ ਸਮੇਂ ਦੀ ਵੀ ਬੱਚਤ ਹੁੰਦੀ ਹੈ ਅਤੇ ਸਾਡੀ ਜਿਹੜੀ ਗੈਸ ਜਾਂ ਬਾਲਣ ਉਹ ਘੱਟ ਜਲਦਾ ਹੈ ਕਿਉਂਕਿ ਥੋੜ੍ਹੇ ਸਮੇਂ ਵਿੱਚ ਜਿਹੜੀ ਸਾਡੀ ਦਾਲ ਹੈ ਉਹ ਤਿਆਰ ਹੋ ਜਾਂਦੀ ਹੈ ਪਰ ਇਸਦੇ ਨਾਲ ਨੁਕਸਾਨ ਇਹ ਹੈ ਕਿ ਪ੍ਰੈਸ਼ਰ ਕੁੱਕਰ ਦੇ ਵਿੱਚ ਜਿਹੜੀ ਦਾਲ ਹੈ ਉਹ ਪੱਕਦੀ ਨਹੀਂ ਹੈ ਗਲਦੀ ਹੈ ਜਿਹਦੇ ਨਾਲ ਕਿ ਸਾਨੂੰ ਪੇਟ ਵਿੱਚ ਗੈਸ ਅਫਾਰਾ ਆਦਿ ਜਿਹੜਾ ਹੈ ਉਹ ਸਾਨੂੰ ਮਹਿਸੂਸ ਹੁੰਦਾ ਹੈ ਸਾਨੂੰ ਉਸ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਅ ਜਿਹੜਾ ਪ੍ਰੈਸ਼ਰ ਕੁੱਕਰ ਅ ਜਿਹੜਾ ਹੈ ਇਸਦੇ ਨਾਲੋਂ ਜਦੋਂ ਅਸੀਂ ਪਤੀਲੇ ਦੀ ਦਾਲ ਅ ਖਾਂਦੇ ਹਾਂ ਤਾਂ ਪਤੀਲੇ ਵਿੱਚ ਭਾਵੇਂ ਕਿ ਹੌਲੀ ਹੌਲੀ ਦਾਲ ਬਣਦੀ ਹੈ ਪਰ ਉਹ ਖਾਣ ਤੋਂ ਬਾਅਦ ਸਾਡਾ ਜਿਹੜਾ ਹਾਜ਼ਮਾ ਉਹ ਬਿਲਕੁਲ ਖਰਾਬ ਨਹੀਂ ਹੁੰਦਾ